ਮੈਂ ਇੱਕ ਫੋਟੋਗ੍ਰਾਫਰ ਹਾਂ ਅਤੇ ਫੋਟੋਗ੍ਰਾਫੀ ਲਈ ਮੈਂ ਰਸਮੀ ਸਿਖਲਾਈ ਲਈ ਸੀ ਮੈਂ ਵਧੀਆ ਫੋਟੋਗ੍ਰਾਫਰ ਬਣਨ ਲਈ ਆਪਣੇ ਹੁਨਰ ਨੂੰ ਰੋਜ਼ ਸੁਧਾਰਦੀ ਰਹਿੰਦੀ ਹਾਂ ਕੁਝ ਨਾ ਕੁਝ ਨਵਾਂ ਸਿੱਖਦੀ ਰਹਿੰਦੀ ਹਾਂ ਅਤੇ ਫੋਟੋਗ੍ਰਾਫੀ ਵਿੱਚ ਜਾਂ ਫੋਟੋਆਂ ਕਰਨ ਸਮੇਂ ਉਹਨਾਂ ਨੂੰ ਅਜਮਾਉਂਦੀ ਰਹਿੰਦੀ ਹਾਂ ਅਤੇ ਸੁਧਾਰ ਕਰਦੀ ਰਹਿੰਦੀ ਹਾਂ ਮੈਨੂੰ ਕੁਦਰਤੀ ਤਸਵੀਰਾਂ ਜਿਵੇਂ ਫੁੱਲਾਂ ਉੱਪਰ ਉੱਪਰ ਪਈ ਤਰੇਲ ਜਾਂ ਜਦੋਂ ਪਾਣੀ ਦੀ ਬੂੰਦ ਨੀਚੇ ਗਿਰਦੀ ਹੈ ਇੱਦਾਂ ਦੀਆਂ ਫੋਟੋਆਂ ਕਰਨੀਆਂ ਬਹੁਤ ਪਸੰਦ ਹਨ ਅਤੇ ਜਿੱਦਾਂ ਕੋਈ ਵੀ ਪੰਛੀ ਜਾਨਵਰ ਦੀ ਫੋਟੋ ਵੀ ਮੈਨੂੰ ਵਧੀਆ ਲੱਗਦੀ ਹੈ ਖਿੱਚਣੀ ਜਾਂ ਜਦੋਂ ਕੋਈ ਬੱਚਾ ਹਰਕਤ ਕਰਦਾ ਹੈ ਤਾਂ ਉਹਦੀ ਉਸ ਪਲ ਨੂੰ ਕਿੱਦਾਂ ਕੈਮਰੇ ਵਿੱਚ ਕੈਦ ਕਰਨਾ ਹੈ ਉਹ ਵੀ ਮੈਨੂੰ ਬਹੁਤ ਪਸੰਦ ਹੈ ਅਤੇ ਮੇਰੀ ਪ੍ਰੇਰਨਾ ਸ਼ੋਸ਼ਲ ਮੀਡੀਆ ਹੈ ਜਿਵੇਂ ਕਿ ਮੈਂ ਸ਼ੋਸ਼ਲ ਮੀਡੀਆ ਉੱਪਰ ਵੇਖਦੀ ਸੀ ਕਿ ਇੱਦਾਂ ਫੋਟੋ ਹੁੰਦੀ ਹੈ ਅੱਛਾ ਇਹ ਫੋਟੋ ਬਹੁਤ ਸੋਹਣੀ ਕੀਤੀ ਹੈ ਤਾਂ ਉੱਥੋਂ ਹੀ ਮੈਨੂੰ ਇਹ ਸ਼ੌਂਕ ਹੋਇਆ ਕਿ ਮੈਂ ਵੀ ਫੋਟੋਗ੍ਰਾਫੀ ਕਰਾਂ ਮੈਂ ਵੀ ਸੋਹਣੀਆਂ ਜਿਹੀਆਂ ਪਿਕਸ ਜਾਂ ਫੋਟੋਆਂ ਖਿੱਚਾਂ ਤਾਂ ਕਿ ਉਸ ਸ਼ੋਸ਼ਲ ਮੀਡੀਆ ਤੋਂ ਮੈਨੂੰ ਇੱਦਾਂ ਲੱਗਾ ਕਿ ਹਾਂ ਮੈਨੂੰ ਇਹ ਕਰਨਾ ਚਾਹੀਦਾ ਹੈ ਮੈਨੂੰ ਇਹ ਬਹੁਤ ਪਸੰਦ ਹੈ ਇਸ ਲਈ ਮੇਰੀ ਪ੍ਰੇਰਨਾ ਸ਼ੋਸ਼ਲ ਮੀਡੀਆ ਹੈ